ਸਵਾਲ ਇਹ ਹੈ ਕਿ ਤੁਹਾਡੇ ਖੇਤਰ ਵਿੱਚ ਕਿਹੜੇ ਕਲਾ ਸਕੂਲ ਕਾਲਜ ਜਾਂ ਸੰਸਥਾਵਾਂ ਹਨ ਜੋ ਵੱਖ ਵੱਖ ਰੂਪ ਵਿੱਚ ਸਿਖਲਾਈ ਜਾਂ ਵਿਦਿਅਕ ਪ੍ਰੋਗਰਾਮ ਪੇਸ਼ ਕਰਦੇ ਹਨ ਤਾਂ ਇਸ ਵਿਸ਼ੇ ਦੇ ਉੱਪਰ ਮੈਂ ਇਹ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਮੇਰਾ ਜਿਹੜਾ ਜ਼ਿਲ੍ਹਾ ਹੈ ਉਹ ਬਰਨਾਲਾ ਹੈ ਬਰਨਾਲੇ ਦੇ ਵਿੱਚ ਦੋ ਕਾਲਜ ਹਨ ਜਿਹੜੇ ਆਹ ਕਲਾ ਦੇ ਖੇਤਰ ਵਿੱਚ ਸਿਖਲਾਈ ਜਾਂ ਵਿਦਿਅਕ ਪ੍ਰੋਗਰਾਮ ਪੇਸ਼ ਕਰਦੇ ਹਨ ਪਹਿਲਾ ਹੈਗਾ ਸੁਖਮਣੀ ਆਰਟ ਐਂਡ ਕ੍ਰਾਫਟ ਇੰਸਟੀਟਿਊਟ ਅਤੇ ਦੂਸਰਾ ਹੈ ਪੰਜਾਬ ਟੈਕਨੀਕਲ ਕਾਲਜ ਆਰਟ ਐਂਡ ਕਰਾਫਟ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਵੀ ਇੱਕ ਵਿਦਿਆਰਥੀ ਰਹਿ ਚੁੱਕਾ ਹਾਂ ਕਲਾ ਦੇ ਖੇਤਰ ਵਿੱਚ ਆਰਟ ਐਂਡ ਕਰਾਫਟ ਦੇ ਵਿੱਚ ਮੈਂ ਦੋ ਸਾਲ ਦਾ ਡਿਪਲੋਮਾ ਜਿਹੜਾ ਹੈਗਾ ਉਹ ਅ ਸੁਖਮਣੀ ਇਸਟੀਟਿਊਟ ਆਫ ਬਰਨਾਲਾ ਦੇ ਵਿੱਚੋਂ ਕੀਤਾ ਜੇ ਆਪਾਂ ਸਰਕਾਰੀ ਕਾਲਜਾਂ ਦੀ ਗੱਲ ਕਰੀਏ ਤਾਂ ਸਰਕਾਰੀ ਕੋਲਜ ਕਲਾ ਦੇ ਖੇਤਰ ਵਿੱਚ ਸਾਡੇ ਇਲਾਕੇ ਵਿੱਚ ਜੋ ਸਥਿਤ ਹੈ ਉਹ ਨਾਭਾ ਕਾਲਜ ਹੈ ਜ਼ਿਲ੍ਹਾ ਪਟਿਆਲਾ ਗਾ ਮੇਰਾ ਖਿਆਲ ਅਤੇ ਕਲਾ ਦੇ ਖੇਤਰ ਵਿੱਚ ਜੇ ਤੁਸੀਂ ਰੁਚੀ ਰੱਖਦੇ ਹੋ ਪੈਂਸਿਲ ਸ਼ੇਡਿੰਗ ਦੇ ਵਿੱਚ ਆਇਲ ਪੇਸਟਰ ਕਲਰ ਵਰਤਣ ਦੇ ਵਿੱਚ ਜਾਂ ਪੈਂਸਿਲ ਸਕੈਚਿੰਗ ਦੇ ਵਿੱਚ ਜਾਂ ਵਾਟਰ ਕਲਰ ਯੂਜ਼ ਕਰਨ ਦੇ ਵਿੱਚ ਜੇ ਤੁਸੀਂ ਅਤੇ ਜੇ ਤੁਹਾਨੂੰ ਸ਼ੌਂਕ ਹੈ ਕੁਝ ਸਿੱਖਣ ਦਾ ਤਾਂ ਤੁਸੀਂ ਇਹਨਾਂ ਸਿਖਲਾਈ ਜਾਂ ਵਿਦਿਅਕ ਪ੍ਰੋਗਰਾਮਾਂ ਵੱਲ ਜਾ ਸਕਦੇ ਹੋ ਜਿਹੜੇ ਕਿ ਜਨਤਕ ਨੇ ਕੋਈ ਵੀ ਉਹਨਾਂ 'ਚ ਦਾਖਲਾ ਲੈ ਸਕਦਾ ਹੈ ਉਹਦੇ ਲਈ ਕੋਈ ਖ਼ਾਸ ਰਿਕੁਇਰਮੈਂਟ ਨਹੀਂ ਹੈ ਸਿਰਫ ਦਸਵੀਂ ਜਾਂ ਬਾਰਵੀਂ ਵਿੱਚ ਜੇ ਤੁਸੀਂ ਦਸਵੀਂ ਬੇਸ 'ਤੇ ਉਸ ਵਿਦਿ ਕਾਲਜ ਵਿੱਚ ਦਾਖਲਾ ਲੈ ਰਹੇ ਹੋ ਤਾਂ ਤੁਹਾਡੀ ਦਸਵੀਂ ਦੇ ਵਿੱਚ ਡਰਾਇੰਗ ਵਿਸ਼ਾ ਹੋਣਾ ਲਾਜ਼ਮੀ ਹੈ ਜੇ ਤੁਸੀਂ ਬਾਰਵੀਂ ਦੇ ਬੇਸ 'ਤੇ ਲੈ ਰਹੇ ਹੋ ਤਾਂ ਤੁਹਾਡੇ ਕੋਲ ਬਾਰਵੀਂ ਜਮਾਤ ਵਿੱਚ ਡਰਾਇੰਗ ਵਿਸ਼ਾ ਹੈ ਉਹ ਹੋਣਾ ਲਾਜ਼ਮੀ ਹੈ ਉਸ ਬੇਸ 'ਤੇ ਫਿਰ ਤੁਹਾਨੂੰ ਡੀ ਮੈਰਿਟ ਲਿਸਟ ਬਣਦੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਕਾਲਜ ਵਿੱਚ ਦਾਖਲਾ ਦਿੱਤਾ ਜਾਂਦਾ ਹੈ ਉਸ ਸੰਸਥਾ ਦੇ ਵਿੱਚ ਬਾਕਮਾਲ ਦੇ ਟੀਚਰ ਹਨ ਜਿੱਥੋਂ ਤੱਕ ਮੈਨੂੰ ਸਿੱਖਣ ਨੂੰ ਮਿਲਿਆ ਬਹੁਤ ਹੀ ਕਮਾਲ ਦੇ ਅਧਿਆਪਕ ਹਨ